ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਨੀਆ ਜਿੱਦਾਂ ਕਿ ਇਹਨਾਂ ਦਾ ਸਵਾਲ ਇਹ ਹੈ ਕਿ ਪੰਜਾਬੀ ਭਾਸ਼ਾ ਨੇ ਤੁਹਾਡੇ ਸੱਭਿਆਚਾਰ ਅਤੇ ਪਛਾਣ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਮੈਂ ਇਸ ਦਾ ਜਵਾਬ ਇਸ ਪ੍ਰਕਾਰ ਦੇਣਾ ਚਾਹਵਾਂਗਾ ਕਿ ਪੰਜਾਬੀ ਸ਼ਬਦ ਜਿਸਦਾ ਅਰਥ ਉਹ ਵਿਅਕਤੀ ਹੋ ਸਕਦਾ ਹੈ ਜੋ ਪੰਜਾਬ ਵਿੱਚ ਰਹਿੰਦਾ ਹੈ ਅਤੇ ਪੰਜਾਬੀ ਭਾਸ਼ਾ ਦਾ ਬੋਲਣ ਵਾਲਾ ਹੈ ਇਹ ਨਾਮ ਜੋ ਕਿ ਪੰਜਾਬ ਪੰਜਾਬੀ ਹੈ ਫਾਰਸੀ ਭਾਸ਼ਾ ਤੋਂ ਪੰਜ ਅਤੇ ਅਬ ਤੋਂ ਆਇਆ ਹੈ ਜਿਸ ਵਿੱਚ ਅਬ ਦਾ ਮਤਲਬ ਪਾਣੀ ਹੈ ਪੰਜ ਆਬ ਜਾਂ ਪੰਜਾਬ ਜਿਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਪੰਜ ਦਰਿਆਵਾਂ ਦੀ ਧਰਤੀ ਜਿਸ ਵਿੱਚ ਨਦੀਆਂ ਆਉਂਦੀਆਂ ਹਨ ਜਿੱਦਾਂ ਕਿ ਪੰਜ ਨਦੀਆਂ ਆਪਣੀਆਂ ਪਹਿਲੀ ਜਿਹਲਮ ਨਦੀ ਦੂਜੀ ਚਨਾਬ ਨਦੀ ਤੀਜੀ ਰਾਵੀ ਨਦੀ ਚੌਥੀ ਬਿਆਸ ਨਦੀ ਅਤੇ ਆਖਰੀ ਸਤਲੁਜ ਨਦੀ ਅਗਰ ਮੈਂ ਇਹ ਗੱਲ ਕਰਾਂਗਾ ਕਿ ਪੰਜਾਬੀ ਭਾਸ਼ਾ ਨੇ ਸੱਭਿਆਚਾਰ 'ਤੇ ਕਿੱਦਾਂ ਪ੍ਰਭਾਵਿਤ ਹੋਈ ਹੈ ਅਗਰ ਆਪਾਂ ਆਰਥਿਕ ਰਾਜਨੀਤਿਕ ਜਾਂ ਵਿਗਿਆਨਿਕ ਤਬਦੀਲੀਆਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੱਭਿਆਚਾਰ ਨੂੰ ਗੱਲ ਕਰੀਏ ਤਾਂ ਉਹਨਾਂ ਨੇ ਬਦਲਿਆ ਹੈ ਪਿਛਲੀ ਸਦੀ ਦੌਰਾਨ ਪੰਜਾਬੀ ਸੱਭਿਆਚਾਰ ਵਿੱਚ ਤੇਜ਼ੀ ਨਾਲ ਤਬਦੀਲੀਆਂ ਆਈਆਂ ਹਨ ਇਹ ਤਬਦੀਲੀਆਂ ਨਾ ਸਿਰਫ਼ ਸਾਡੇ ਕੰਮ ਕਰਨ ਦੇ ਢੰਗ ਅਤੇ ਸਾਡੀਆਂ ਜ਼ਰੂਰਤਾਂ ਬਲਕੀਆਂ ਸਾਡੇ ਇਰਾਦੇ ਅਤੇ ਸਾਡੀ ਮਾਨਸਿਕਤਾ ਬਦਲਣ ਦੀਆ ਹੋਰ ਜ਼ਰੂਰਤਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬੀ ਭਾਸ਼ਾ ਪੰਜਾਬ ਦੇ ਹਰ ਇੱਕ ਖੇਤਰ ਖੇਤਰ ਵਿੱਚ ਵੱਖਰੀ ਵੱਖਰੀ ਬੋਲੀ ਜਾਂਦੀ ਹਨ ਜਿੱਦਾਂ ਕਿ ਦੁਆਬਾ ਮਾਝਾ ਵਿੱਚ ਬੋਲੀਆਂ ਜਾਣ ਵਾਲੀ ਵੱਖ ਵੱਖ ਇਹਨਾਂ ਦੇ ਏਸੈਂਟ ਵੱਖਰੇ ਹੁੰਦੇ ਹਨ ਜੋ ਕਿ ਸਾਡੀ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਪਹਿਚਾਣ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਹੈ ਧੰਨਵਾਦ